ਭਾਰਤ ਵਿੱਚ ਬਹੁਤ ਸਾਰੇ ਕਲਾਕਾਰ ਇਸੇ ਕਰਕੇ ਪਿੱਛੇ ਰਹਿ ਜਾਂਦੇ ਹਨ ਜਾਂ ਆਪਣੀ ਕਲਾ ਨੂੰ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਆਪਣੀ ਕਲਾ ਰਾਹੀਂ ਉਨ੍ਹਾਂ ਦਾ ਅੱਗੇ ਭਵਿੱਖ ਸੁਰੱਖਿਅਤ ਨਹੀਂ ਦਿਸਦਾ ਸਕੂਲਾਂ ਕਾਲਜਾਂ ਵਿੱਚ ਕਲਾਕਾਰ ਬੱਚਿਆਂ ਲਈ ਕੋਈ ਸਟੋਰ ਨਹੀਂ ਮਿਲਦਾ ਜਿੱਥੇ ਉਹ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਸਪਲਾਈ ਕਰ ਸਕਣ ਅਤੇ ਆਪਣੀ ਰੋਜ਼ੀ ਰੋਟੀ ਕਮਾ ਸਕਣ ਇਸ ਲਈ ਉਹ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਮੈਂ ਖੁਦ ਵੀ ਕਲਾਕਾਰ ਹਾਂ ਅਤੇ ਸ਼ਿਲਪਕਾਰੀ ਵਿੱਚ ਹਾਂ ਮੈਂ ਲੱਕੜੀ ਦੀਆਂ ਟੋਕਰੀਆਂ ਬਣਾ ਲੈਂਦਾ ਹਾਂ ਇਸ ਨੂੰ ਬਣਾਉਣ ਲਈ ਮੈਨੂੰ ਤੂਤ ਦੀਆਂ ਛਟੀਆਂ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਕੱਟਣ ਲਈ ਕਟਰ ਅਤੇ ਉਨਾਂ ਨੂੰ ਛਿਲਣ ਲਈ ਇੱਕ ਲੱਕੜ ਕੱਟਣ ਵਾਲੇ ਬਲੇਟ ਦੀ ਜਾਂ ਦਾਤ ਦੀ ਲੋੜ ਪੈਂਦੀ ਹੈ